ਹਾਂ ਸਾਡੇ ਖੇਤਰ ਦੇ ਵਿੱਚ ਔਰਤਾਂ ਦੀ ਭੂਮਿਕਾ ਬਦਲੀ ਹੈ ਪਹਿਲਾਂ ਕੀ ਹੁੰਦਾ ਸੀ ਕਿ ਉਹਨਾਂ ਨੂੰ ਘਰ ਦੇ ਵਿੱਚ ਕੈਦ ਇੱਕ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਬਣਾ ਕੇ ਰੱਖ ਲਿਆ ਜਾਂਦਾ ਸੀ ਘਰ ਦੇ ਕੰਮਾਂ ਦੇ ਵਿੱਚ ਬਸ ਲੱਗੀ ਰਹਿ ਸਾਰਾ ਦਿਨ ਪਹਿਲਾਂ ਕਿਹੜੀਆਂ ਪੜ੍ਹਾਈਆਂ ਕਰਦੀਆਂ ਸੀ ਹੁਣ ਉਹ ਖੁੱਲ੍ਹ ਕੇ ਆਪਣੀ ਜ਼ਿੰਦਗੀ ਜਿਉਂਦੀਆਂ ਨੇ ਖੁੱਲ੍ਹ ਕੇ ਪੜ੍ਹਾਈ ਵੀ ਕਰਦੀਆਂ ਨੇ ਹੋਰ ਵੀ ਕੰਮ ਕਰਦੀਆਂ ਨੇ ਘਰ ਦੇ ਕੰਮਾਂ ਦੇ ਨਾਲ ਨਾਲ ਉਹ ਕਿੱਤਾ ਮੁਖੀ ਕੰਮ ਹੀ ਕਰਦੀਆਂ ਨੇ ਜਿਹਦੇ ਨਾਲ ਉਹ ਆਪਣੀ ਰੋਜ਼ੀ ਰੋਟੀ ਕਮਾ ਸਕਣ ਹੁਣ ਉਹਨਾਂ ਦੇ ਨਾਲ ਮਰਦ ਵੀ ਬਰਾਬਰ ਯੋਗਦਾਨ ਦੇਣ ਲੱਗ ਗਏ ਨੇ ਘਰ ਦੇ ਕੰਮ ਇਕੱਲੀਆਂ ਔਰਤਾਂ 'ਤੇ ਨਹੀਂ ਛੱਡਿਆ ਗਿਆ ਹੁਣ ਨਾਲ ਸਾਰੇ ਸਹਾਇਤਾ ਕਰਦੇ ਨੇ ਹੁਣ ਔਰਤਾਂ ਨੂੰ ਸਮਝਣਾ ਸ਼ੁਰੂ ਕਰ ਤਾ ਸਮਾਜ ਨੇ ਔਰਤ ਦੀ ਵੀ ਜ਼ਿੰਦਗੀ ਹੈ ਕੋਈ ਉਹਦੀ ਵੀ ਇੱਕ ਕੋਈ ਆਪਣੀ ਲਾਈਫ ਹੈ ਉਹਨੂੰ ਜਿਉਂਦੀ ਹੈ ਅਤੇ ਰੁਕਾਵਟਾਂ ਬੜੀਆਂ ਆਉਂਦੀਆਂ ਹਨ ਜਿਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਗਰ ਤੁਸੀਂ ਘਰ ਦੇ ਵਿੱਚ ਹੀ ਰਹੋ ਅਤੇ ਘਰ ਦੇ ਵਿੱਚ ਵੀ ਬੜੀਆਂ ਸਾਰੀਆਂ ਹੁੰਦੀਆਂ ਨੇ ਮੁਸੀਬਤਾਂ ਜਿਵੇਂ ਕਿਸੇ ਨੂੰ ਆਹ ਸਬਜ਼ੀ ਪਸੰਦ ਨਹੀਂ ਤੁਸੀਂ ਕਿਵੇਂ ਬਣਾ ਲਈ ਜੇ ਉਸ ਔਰਤ ਨੂੰ ਮੰਨ ਲਓ ਚੀਜ਼ ਪਸੰਦ ਏ ਉਹਨੇ ਆਪਣੀ ਮਰਜ਼ੀ ਦਾ ਕੁਛ ਬਣਾ ਲਿਆ ਉਹਨੂੰ ਕਹਿੰਦੇ ਨੇ ਵੀ ਕਿਉਂ ਬਣਾ ਲਿਆ ਜੀ ਤੂੰ ਕਿਸੇ ਨੂੰ ਪਸੰਦ ਨਹੀਂ ਹੈਗਾ ਅਗਰ ਉਹ ਬਾਹਰ ਕੰਮ ਕਰਨ ਚਲੇ ਜਾਏ ਅਤੇ ਉਹਦੇ ਨਾਲ ਬਸ ਭੈੜੀਆਂ ਨਿਗਾ ਨਾਲ ਹੀ ਵੇਖਿਆ ਜਾਂਦਾ ਔਰਤ ਦੇ ਕੱਪੜਿਆਂ ਨੂੰ ਵੇਖਿਆ ਜਾਂਦਾ ਕਿ ਕਿਵੇਂ ਦੇ ਪਾਏ ਨੇ ਕੱਪੜਿਆਂ ਤੋਂ ਉਹਨੂੰ ਜੱਜ ਕੀਤਾ ਜਾਂਦਾ ਕਿਵੇਂ ਦੀ ਹੈ ਖੁੱਲ੍ਹ ਕੇ ਕੋਈ ਹੱਸ ਲੈਂਦੀ ਹੈ ਤਾਂ ਉਹਨੂੰ ਕਹਿ ਦਿੰਦੇ ਨੇ ਵੀ ਹਾਂ ਜ਼ਿਆਦਾ ਹੱਸਦੀ ਹੈ ਜੇ ਕੋਈ ਨਹੀਂ ਹੱਸਦੀ ਅਤੇ ਉਹਨੂੰ ਕਹਿਣਗੇ ਹਾਂ ਜੀ ਬੋਲਦੀ ਨਹੀਂ ਆਕੜ ਆ ਗਈ ਇਹਦੇ ਵਿੱਚ ਰੁਕਾਵਟਾਂ ਵੀ ਬੜੀਆਂ ਆਉਂਦੀਆਂ ਨੇ ਕਈ ਵਾਰੀ ਔਰਤ ਨੂੰ ਕਹਿ ਦਿੱਤਾ ਜਾਂਦਾ ਤੈਨੂੰ ਕਿਹੜਾ ਪਤਾ ਲੱਗਦਾ ਬਾਹਰੋਂ ਸਮਾਨ ਤੂੰ ਕਿਹੜਾ ਖਰੀਦ ਸਕਦੀ ਹੈ ਤੈਨੂੰ ਕਿਹੜਾ ਕਿਸੇ ਨਾਲ ਗੱਲ ਕਰਨੀ ਆਉਂਦੀ ਹੈ ਤਾਂ ਹਾਂ ਬਦਲਦੀ ਵੀ ਹੈ ਹੌਲੀ ਹੌਲੀ ਬਦਲਦੀ ਜਾਂਦੀ ਆ ਹੁਣ ਪੜ੍ਹਾਈ ਕਰਕੇ ਬਰਾਬਰ ਖੜ੍ਹਨ ਵਾਲੀਆਂ ਹੋ ਗਈਆਂ ਨੇ ਔਰਤਾਂ